ਹਾਂਜੀ ਮੈਂ ਹਰਬਲ ਨਰਸਰੀ ਤੋਂ ਬੋਲਦਾ ਤੁਹਾਡਾ ਫੋਨ ਆਇਆ ਹੋਇਆ ਸੀ ਠੀਕ ਹੈ ਜੀ ਕਿਹੜੇ ਜੀ ਹਾਂ ਗੁਲਾਬ ਸਾਡੇ ਕੋਲ ਵਾਈਟ ਗੁਲਾਬ ਮਿਲਜੂਗਾ ਅਤੇ ਚਿੱਟਾ ਗੁਲਾਬ ਵੀ ਮਿਲਜੂਗਾ ਗੁ ਗੁਲਾਬੀ ਪਿੰਕ ਗੁਲਾਬ ਵੀ ਮਿਲਜੂਗਾ ਹਾਂਜੀ ਕਈ ਵਿਰਾਈਟੀ ਆਪਣੇ ਕੋਲੇ ਹਾਂਜੀ ਹਾਂਜੀ ਹਾਂਜੀ ਤੁਸੀਂ ਪਹਿਲਾਂ ਵਿਜਿਟ ਕੀਤਾ ਸੀ ਜੀ ਇੱਥੇ ਸਾਡੀ ਨਰਸਰੀ ਵਿਜਿਟ ਕੀਤੀ ਸੀ

ਹਾਂਜੀ ਹਾਂਜੀ ਹਾਂਜੀ ਹਾਂਜੀ ਰੇਟ ਤਾਂ ਜੀ ਡਿਪੈਂਡ ਕਰਦਾ ਨਾ ਵੀ ਜਿਹੜਾ ਬੂਟਾ ਹੈ ਉਹ ਕਿੰਨਾ ਕੁ ਮਤਲਬ ਪੁਰਾਣਾ ਹੈ ਕਿਉਂਕਿ ਛੋਟੇ ਹੁੰਦੇ ਆ ਉਹਨਾਂ ਦਾ ਰੇਟ ਥੋੜ੍ਹਾ ਘੱਟ ਹੁੰਦਾ ਜਿਹੜੇ ਦੋ ਮਹੀਨੇ ਦੋ ਮਹੀਨੇ ਦੇ ਜਿਹੜਾ ਵੱਡਾ ਹੋ ਗਿਆ ਉਹਦੇ ਬਾਅਦ ਰੇਟ ਥੋੜ੍ਹਾ ਜਿਹਾ ਅ ਅੱਪ ਹੋ ਜਾਂਦੇ ਜੀ ਲੇਕਿਨ ਆਪਾਂ ਵਾਜਿਬ ਦਾਮ 'ਤੇ ਲਗਾਵਾਂਗੇ ਜੀ ਤੁਸੀਂ ਆਇਓ ਅਤੇ ਹਾਂਜੀ ਹਾਂਜੀ ਟਾਈਮਿੰਗ ਜੀ ਆਪਣੀ ਸਵੇਰੇ ਨੋਂ ਵਜੇ ਤੋਂ ਲੈ ਕੇ ਸ਼ਾਮ ਨੂੰ ਸੱਤ ਵਜੇ ਤੱਕ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਤੁਸੀਂ ਫੋਨ ਕਰਦਿਓ ਫਿਰ ਮੈਂ ਵੇ ਵੇਟ ਕਰ ਲੂੰਗਾ ਤੁਹਾ ਤੁਹਾਡਾ ਹੈ ਨਾ ਅਤੇ ਤੁਹਾਨੂੰ ਕਿੰਨੀ ਕੁਆਂਟਿਟੀ 'ਚ ਚਾਹੀਦੇ ਹੈ ਜੀ ਅੱਛਿਆ ਜੀ ਜ਼ਿਆਦਾ ਮੈਂ ਸੋਚਿਆ ਵੀ ਜੇ ਬਾਹਲਾ ਬਲਕ ਸੀ ਚਾਹੀਦਾ ਫਿਰ ਤਾਂ ਪਹਿਲਾਂ ਔਡਰ ਕਰਨਾ ਪੈਣਾ ਆਪਾਂ ਨੂੰ ਜੇ ਥੋੜ੍ਹੀ ਬਹੁਤੀ ਹਾਂਜੀ ਠੀਕ ਹੈ ਜੀ ਘਰ ਉੱਤੇ ਛੱਤ ਦੇ ਉੱਤੇ ਲਗਾਉਣੇ ਆ ਹੈਂਗਿੰਗ ਗਾਰਡਨ ਬਣਿਆ ਹੋਇਆ ਜਾਂ ਬਾਹਰ ਥੱਲੇ ਗਰਾਊਂਡ ਫਲੋਰ 'ਤੇ ਹੀ ਹੈ ਠੀਕ ਹੈ ਜੀ

ਹਾਂ ਉਹਨਾਂ ਨੂੰ ਕਵਰ ਕਰਕੇ ਰੱਖਣਾ ਪੈਂਦਾ ਜੀ ਬਸ ਇਹ ਹੀ ਪ੍ਰੀਕੁਸ਼ਚਨ ਹੈ ਥੋੜ੍ਹੇ ਮੈਂ ਤੁਹਾਨੂੰ ਦੱਸ ਦੂੰਗਾ ਸਾਰੇ ਵੀ ਕਿਹੜਾ ਜਿਹੜਾ ਬੂਟਾ ਉਹਨੂੰ ਕੀ ਕੀ ਚੀਜ਼ਾਂ ਚਾਹੀਦੀ ਆਪਾਂ ਨੂੰ ਕਿਹੜੇ ਨੂੰ ਆਪਾਂ ਡਾਇਰੈਕਟ ਸਨਲਾਈਟ ਦੇਣੀ ਹੈ ਨਹੀਂ ਦੇਣੀ ਕਿੰਨੇ ਕੁ ਟਾਈਮ ਤੱਕ ਉਹਨੂੰ ਆਪਾਂ ਰੱਖਣਾ ਉਹ ਸਾਰੇ ਚੀਜ਼ਾਂ ਮੈਂ ਤੁਹਾਨੂੰ ਦੱਸ ਦੂੰਗਾ ਜਦੋਂ ਤੁਸੀਂ ਆਓਗੇ ਬਾਕੀ ਕੁਆਲਿਟੀ ਇੱਕ ਨੰਬਰ ਦਵਾਂਗੇ ਜੀ ਜਿਵੇਂ ਮਤਲਬ ਤੁਹਾਨੂੰ ਉਹਦੀ ਕੁਆਲਿਟੀ ਤੁਹਾਨੂੰ ਬਠਿੰਡੇ 'ਚ ਨਹੀਂ ਮਿਲਣੀ ਹਾਂਜੀ ਹਾਂਜੀ ਜ਼ਰੂਰ ਤੁਸੀਂ ਵਿਜਿਟ ਕਰਕੇ ਸਾਨੂੰ ਮੌਕਾ ਦਿਓ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਜੀ ਓਕੇ ਜੀ ਓਕੇ ਮੈਨੂੰ ਫੋਨ ਕਰ ਲਿਓ ਤੁਸੀਂ ਜਦੋਂ ਆਉਣਾ ਹਾਂਜੀ ਹਾਂਜੀ ਓਕੇ ਜੀ ਧੰਨਵਾਦ ਧੰਨਵਾਦ ਜੀ